ਮੈਂ ਕੱਪੜੇ ਦੋ ਤਰੀਕੇ ਨਾਲ਼ ਧੋਨੀ ਹਾਂ ਗਰਮੀਆਂ ਵਿੱਚ ਮੈਂ ਕੱਪੜੇ ਹੱਥਾਂ ਨਾਲ਼ ਧੋਨੀ ਹਾਂ ਸਰਦੀਆਂ ਵਿੱਚ ਮੈਂ ਕੱਪੜੇ ਮਸ਼ੀਨ ਵਿੱਚ ਧੋਨੀ ਹਾਂ ਗਰਮੀਆਂ ਵਿੱਚ ਬਾਲਟੀ ਵਿੱਚ ਸਰਫ ਅਤੇ ਪਾਣੀ ਪਾ ਕੇ ਕੱਪੜਿਆਂ ਨੂੰ ਥੋੜ੍ਹਾ ਟਾਈਮ ਡੁਬੋ ਕੇ ਰੱਖਦੀ ਹਾਂ ਅਤੇ ਉਸਦੇ ਬਾਅਦ ਉਹਨਾਂ 'ਤੇ ਬਰੱਸ਼ ਮਾਰਦੀ ਹਾਂ ਅਗਰ ਕੋਈ ਦਾਗ ਹੈ ਅਤੇ ਉਥੇ ਚੰਗੀ ਤਰਾਂ ਸਾਬਣ ਲਗਾ ਕੇ ਇਸਨੂੰ ਚੰਗੀ ਤਰ੍ਹਾਂ ਬਰੱਸ਼ ਨਾਲ਼ ਸਾਫ ਕਰਦੀ ਹਾਂ ਅਤੇ ਉਸ ਤੋਂ ਬਾਅਦ ਸਾਫ ਪਾਣੀ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਚਿੱਟੇ ਕੱਪੜਿਆਂ ਨੂੰ ਮੈਂ ਨੀਲ ਦਿੰਨੀ ਹਾਂ ਅਤੇ ਉਸ ਤੋਂ ਬਾਅਦ ਛੱਤ 'ਤੇ ਪਾ ਆਉਨੀ ਹਾਂ ਅਤੇ ਗਰਮੀਆਂ ਵਿੱਚ ਕੱਪੜਿਆਂ ਨੂੰ ਮੈਂ ਘੱਟ ਧੁੱਪ ਵਿੱਚ ਸੁਕਾਉਂਨੀ ਹਾਂ ਅਤੇ ਉਸ ਤੋਂ ਬਾਅਦ ਕੱਪੜਿਆਂ ਨੂੰ ਸੁਕਾਉਣ ਤੋਂ ਬਾਅਦ ਮੈਂ ਕੱਪੜਿਆਂ ਨੂੰ ਲਿ ਉਤਾਰ ਕੇ ਲਿਆਉਂਨੀ ਹਾਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੈੱਸ ਕਰਕੇ ਰੱਖ ਦਿੰਨੀ ਹਾਂ ਸਰਦੀਆਂ ਵਿੱਚ ਮੈਂ ਕੱਪੜਿਆਂ ਨੂੰ ਮਸ਼ੀਨ ਵਿੱਚ ਧੋਨੀ ਹੈ ਮਸ਼ੀਨ ਵਿੱਚ ਸਰਫ ਪਾ ਕੇ ਪਾਣੀ ਪਾ ਕੇ ਚੰਗੀ ਤਰ੍ਹਾਂ ਦਸ ਪੰਦਰ੍ਹਾਂ ਮਿੰਟ ਰਾਊਂਡ ਦੁਆ ਕੇ ਉਨ੍ਹਾਂ ਨੂੰ ਸਾਫ ਪਾਣੀ ਵਿੱਚ ਕੱਢਦੀ ਐਂ ਚਿੱਟੇ ਕੱਪੜਿਆਂ ਨੂੰ ਨੀਲ ਦੇ ਦਿੰਨੀ ਹਾਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮਸ਼ੀਨ ਵਿੱਚ ਸੁੱਕਾ ਕੇ ਛੱਤ 'ਤੇ ਪਾ ਆਉਂਨੀ ਹਾਂ ਅਤੇ ਉਸ ਤੋਂ ਬਾਆਦ ਸੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਉਪਰੋਂ ਉਤਾਰ ਲਿਆਉਨੀ ਹਾਂ ਅਤੇ ਪ੍ਰੈੱਸ ਕਰਕੇ ਅਲਮਾਰੀ ਵਿੱਚ ਰੱਖ ਦਿੰਦੀ ਹਾਂ